ਪੰਜਾਬ 'ਚ ਵਪਾਰਿਕ ਬਹੁਤ ਕੰਮ ਵੱਧ ਗਿਆ ਹੈ ਜਿਸ ਕਰਕੇ ਬਾਹਰ ਦੀ ਕੰਪਨੀਆਂ ਨੇ ਇੱਥੇ ਆਪਣੇ ਮਾਲ ਖੋਲ੍ਹ ਲਏ ਹਨ ਅਤੇ ਬਾਹਰ ਉਹਨਾਂ ਨੇ ਆਪਣੀਆਂ ਮਾਲਾਂ 'ਚ ਬਾਹਰ ਦੀ ਕੰਪਨੀਆਂ ਦੇ ਦੁਕਾਨਾਂ ਖੋਲ੍ਹ ਲਈਆਂ ਹਨ ਜਿਸ ਕਰਕੇ ਪੰਜਾਬ 'ਚ ਕੰਮ ਬਹੁਤ ਵੱਧ ਗਿਆ ਹੈ ਅੱਜ ਕੱਲ੍ਹ ਬੰਦੇ ਨੂੰ ਪੈਸਾ ਭੇਜਣ ਵਾਸਤੇ ਕੋਈ ਟਾਈਮ ਨਹੀਂ ਲੱਗਦਾ ਅੱਜ ਕੱਲ੍ਹ ਔਨਲਾਈਨ ਪੇਮੈਂਟ ਹੋ ਜਾਂਦੀ ਹੈ ਜਿਸ ਕਰਕੇ ਬੰਦਾ ਜਿੰਨੀ ਮਰਜ਼ੀ ਪੇਮੈਂਟ ਮੰਗਵਾ ਸਕਦਾ ਹੈ ਅਤੇ ਪੇਮੈਂਟ ਦੂਜੇ ਪਾਸੇ ਭੇਜ ਸਕਦਾ ਹੈ ਜਿਸ ਕਰਕੇ ਬਹੁਤ ਫਾਇਦਾ ਹੋ ਗਿਆ ਇਸ ਕਰਕੇ ਬਹੁਤ ਕੰਮ ਚੱਲ ਰਿਹਾ ਹੈ ਅਤੇ ਗੌਰਮਿੰਟ ਨੇ ਵੀ ਕਈ ਇੱਦਾਂ ਦੀ ਸਕੀਮਾਂ ਖੋਲ੍ਹੀਆਂ ਹੋਈਆਂ ਜਿਸ ਕਰਕੇ ਬੱਚੇ ਲੋਨ ਲੈ ਕੇ ਆਪਣਾ ਕੰਮ ਕਰ ਸਕਣ ਕੰਮ ਕਰਨ ਨਾਲ ਅੱਗੇ ਬੱਚਿਆਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਅੱਗੇ ਛੋਟੇ ਬੱਚ ਛੋਟਿਆਂ ਆਪਣੇ ਤੋਂ ਬ ਛੋਟੇ ਬੱਚਿਆਂ ਨੂੰ ਭਰਾਵਾਂ ਨੂੰ ਵੀ ਰੁਜ਼ਗਾਰ ਦੇ ਸਕਦੇ ਹਨ ਜਿਸ ਕਰਕੇ ਪੰਜਾਬ ਅੱਜ ਕੱਲ੍ਹ ਬਹੁਤ ਤਰੱਕੀ 'ਤੇ ਹੈ ਅਤੇ ਇਸ ਦੇ ਨਾਲ ਸ ਸਭ ਕੁਛ ਅੱਗੇ ਵੱਧ ਰਿਹਾ ਹੈ